ਪਿੰਡ ਵਿੱਚ ਬਿਜਲੀ ਲਈ ਮਤਲਬ ਕੰਮ ਕੀਤੇ ਜਾ ਸਕਦੇ ਹਨ ਜਿੱਦਾਂ ਕਿ ਤੁਸੀਂ ਸੋਲਰ ਪ ਪਲਾਂਟ ਲਗਾ ਸਕਦੇ ਹੋ ਪੰਚਾਇਤ ਸੋਲਰ ਪਾਵਰ ਪਲਾਂਟ ਲਗਾ ਸਕਦੀ ਹੈ ਜਾਂ ਮਤਲਬ ਪਾਣੀ ਦੇ ਜ਼ਰੀਏ ਬਿਜਲੀ ਕ੍ਰੀਏਟ ਕਰ ਸਕਦੀ ਆ ਅਤੇ ਉਹ ਚੀਜ਼ ਕਾਫ਼ੀ ਵਧੀਆ ਰਹਿੰਦੇ ਕਿਉਂਕਿ ਇਹ ਨੈਚੁਰਲ ਤਰੀਕਾ ਅਤੇ ਇਹਦੇ ਵਿੱਚ ਕੋਈ ਜ਼ਿਆਦਾ ਵਰਤੋਂ ਜਾਂ ਪੈਸੇ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਗੌਰਮੈਂਟ ਤੋਂ ਫੰਡਸ ਮਿਲਦੇ ਆ ਅਤੇ ਇਹਨਾਂ ਚੀਜ਼ਾਂ 'ਤੇ ਲਗਾਏ ਜਾ ਸਕਦੇ ਹਨ ਦੂਜੀ ਚੀਜ਼ ਮੈਂ ਮੰਨਦਾ ਕਿ ਜਿੱਦਾਂ ਖੇਤੀ ਵਿੱਚ ਮਾਝਾ ਮਾਲਵਾ ਪੰਜਾਬ ਦੇ ਆਪਾਂ ਏਰੀਏ ਦੇ ਨਿਵਾਸੀ ਹਾਂ ਅਤੇ ਇੱਥੇ ਮਾਝਾ ਮਾਲਵਾ ਵਿੱਚ ਜ਼ਿਆਦਾਤਰ ਲੋਕ ਕਿਸਾਨ ਨੇ ਅਤੇ ਇਹਨਾਂ ਚੀਜ਼ਾਂ 'ਤੇ ਬਿਜਲੀ ਜ਼ਿਆਦਾ ਖਰਚ ਹੁੰਦੀ ਆ ਜਿੱਦਾਂ ਮੋਟਰ ਹੋ ਗਈ ਜਾਂ ਵੱਖ ਵੱਖ ਚੀਜ਼ਾਂ ਜਿਹੜੀਆਂ ਕਿ ਕਿਸਾਨੀ ਭਾਗਾਂ ਵਿੱਚ ਲੱਗਦੀਆਂ ਅਤੇ ਇਹਨਾਂ ਚੀਜ਼ਾਂ 'ਤੇ ਵੀ ਪੈਸੇ ਖਰਚਣਾ ਅਤੇ ਸਰਕਾਰ ਮਤਲਬ ਪੰਚਾਇਤ ਨੂੰ ਇਹ ਹੀ ਚੀਜ਼ ਮੰਗਦਾ ਕਿ ਜਿੱਦਾਂ ਕਿ ਬਿਜਲੀ ਦੀ ਉਤਪਾਦ ਕੀਤੀ ਜਾਵੇ ਮਤਲਬ ਗੌਰਮੈਂਟ ਵੱਲੋਂ ਫੰਡਸ ਮਿਲਦੇ ਹੈਗੇ ਆ ਅਤੇ ਇਹਨਾਂ ਚੀਜ਼ਾਂ 'ਤੇ ਲਗਾਏ ਜਾਣ ਅਤੇ ਅਗਰ ਛੇਤੀ ਵਿੱਚ ਗੱਲ ਕਰੀ ਜਾਵੇ ਕਿ ਮੋਟਰ ਹੋਊਗੀ ਜਾਂ ਵੱਖ ਵੱਖ ਚੀਜ਼ਾਂ ਹੋ ਗਈਆਂ ਜਿਹੜੀ ਕਿ ਕਾਫ਼ੀ ਬਿਜਲੀ ਖਰਚਦੀਆਂ ਹਨ ਇਹਨਾਂ ਨਾਲ ਇਹਨਾਂ ਨਾਲ ਕਿਸਾਨਾਂ ਨੂੰ ਕਾਫ਼ੀ ਮਦਦ ਮਿਲ ਸਕਦੀ ਹੈ ਜੇਕਰ ਪੰਚਾਇਤ ਇਹ ਕਦਮ ਚੁੱਕਣ ਤਾਂ